ਪੰਜਾਬ ਵਿੱਚ ਵੀ ਕਈ ਨਵੇਂ ਆਈ ਟੀ ਰਿਲੇਟਿਡ ਸਟਾਰਟ ਅਪ ਬਣ ਰਹੇ ਹਨ ਨਵੀਆਂ ਐਪਸ ਕਹਿ ਲਓ ਡਿਵੈਲਪ ਹੋਏ ਹਨ ਸੋਫਟਵੇਅਰ ਡਿਵੈਲਪ ਹੋ ਰਹੇ ਹਨ ਜਿਹੜੇ ਕਿ ਹਰ ਹਰ ਹਰ ਸੈਕਟਰ ਹਰ ਉਦਯੋਗ ਵਿੱਚ ਕੰਮ ਆ ਰਹੇ ਹਨ ਦੁਨੀਆਂ 'ਚ ਜੋ ਚੱਲ ਰਹੇ ਹਨ ਉਹ ਤਾਂ ਚੱਲ ਹੀ ਰਹੇ ਹਨ ਗੂਗਲ ਦੇ ਸੋਫਟਵੇਅਰ ਲੈ ਲਓ ਮਾਈਕ੍ਰੋਸਾਫਟ ਦੇ ਲੈ ਲਓ ਬਾਕੀ ਹੋਰ ਲੋਕਲ ਵੀ ਕਈ ਹਨ ਜਿਹੜੇ ਇਸਤੇਮਾਲ ਹੋ ਰਹੇ ਹਨ ਕੰਸਟਰਕਸ਼ਨ ਲਾਈਨ ਹੀ ਲੈ ਲਓ ਫੋਰ ਇੰਗਜ਼ਾਪਲ ਉਦਹਾਰਨ ਦੇ ਤੌਰ 'ਤੇ ਅਤੇ ਉਹਦੇ ਵਿੱਚ ਸ਼ੁਰੂ ਡਿਜ਼ਾਇਨਿੰਗ ਤੋਂ ਲੈ ਕੇ ਆਖਿਰ ਐਗਜੀਕਿਊਸ਼ਨ ਹੈਂਡ ਓਵਰ ਤੱਕ ਕਾਫ਼ੀ ਟੈਕਨੋਲੋਜੀ ਸੈਕਟਰ ਦੀਆਂ ਚੀਜ਼ਾਂ ਇਸਤੇਮਾਲ ਹੁੰਦੀਆਂ ਹਨ ਸ਼ੁਰੂਆਤ 'ਚ ਦੱਸੀਏ ਤਾਂ ਜਿਹੜੇ ਆਰਕੀਟੈਕ ਨੇ ਜਿੱਦਾਂ ਮੈਂ ਵੀ ਹਾਂ ਤਾਂ ਅਸੀਂ ਕਈ ਸੋਫਟਵੇਅਰ ਯੂਜ ਕਰਦੇ ਜਿਹਦੇ 'ਚ ਅਸੀਂ ਡਰਾਇੰਗ ਬਣਾਉਂਦੇ ਹਾਂ ਫਿਰ ਥ੍ਰੀ ਡੀ ਬਣਾਉਂਦੇ ਹਾਂ ਫਿਰ ਕਲਾਇੰਟ ਨਾਲ ਡਿਸਕਸ ਕਰਦੇ ਹਾਂ ਕਿ ਉਹਨਾਂ ਦਾ ਘਰ ਕਿੱਦਾਂ ਦਿਖੇਗਾ ਪਹਿਲਾਂ ਉਹ ਸਭ ਅੱਜ ਕੱਲ੍ਹ ਦੀ ਟੈਕਨੋਲੋਜੀ ਕਰਕੇ ਹੀ ਹੈ ਜੋ ਪਹਿਲਾਂ ਨਹੀਂ ਸੀ ਹੋ ਪਾਉਂਦਾ ਫਿਰ ਅੱਗੇ ਸਾਈਡ ਦੀ ਐਗਜੀਬਿਸ਼ਨ ਲੈ ਲਓ ਅਤੇ ਹੱਥਾਂ ਨਾਲ ਕੰਮ ਤਾਂ ਹੁੰਦਾ ਬਟ ਜਿੱਦਾਂ ਮਾਰਕਿੰਗ ਹੋ ਗਈ ਇੰਚੀਟੇਪਸ ਇਹਨਾਂ ਨਾਲੋਂ ਹੁਣ ਅੱਗੇ ਲੇਜ਼ਰ ਵਾਲੇ ਕਈ ਇੰਸਟੂਮੈਂਟ ਆ ਗਏ ਹਨ ਜਿਹੜੇ ਕਿ ਕਰਕੇ ਆਪੇ ਕੰਪਿਊਟਰ ਵਿੱਚ ਡਰੋਇੰਗ ਬਣਾ ਕੇ ਦੇ ਦਿੰਦੇ ਹਨ ਜਾਂ ਡਰੋਇੰਗ ਦੇ ਮੁਤਾਬਿਕ ਸਾਈਡ 'ਤੇ ਮਾਰਕਿੰਗ ਸ ਦਿਖਾ ਦਿੰਦੇ ਹਨ ਲੇਜਰ ਦੇ ਹਿਸਾਬ ਨਾਲ ਉਹ ਇਸਤੇਮਾਲ ਹੁੰਦੇ ਹਨ ਇੱਦਾਂ ਜਦੋਂ ਮੈਨੇਜਮੈਂਟ ਕਰਨ ਲਈ ਵੀ ਕਈ ਸੋਫਟਵੇਅਰ ਹਨ ਜਿਹ ਨਾਲ ਪਹਿਲਾ ਕੁਆਂਟੀਟੀਜ ਨਿਕਲ ਆਉਂਦੀਆਂ ਹਨ ਡਿਜ਼ਾਇਨ ਦੇ ਹਿਸਾਬ ਨਾਲ ਅਤੇ ਠੇਕੇਦਾਰਾਂ ਦਾ ਵੀ ਕੰਮ ਥੋੜ੍ਹਾ ਆਸਾਨ ਹੋ ਜਾਂਦਾ ਹੈ ਕਲਾਇੰਟਸ ਦਾ ਵੀ ਥੋੜ੍ਹਾ ਐਸਟੀਮੇਟਸ ਲਗਾਉਣਾ ਆਸਾਨ ਹੋ ਜਾਂਦੇ ਹਨ ਕੀ ਕਿੰਨਾ ਖਰਚ ਆਏਗਾ ਉਹਨਾਂ ਦੇ ਪ੍ਰੋਜੈਕਟਸ 'ਤੇ ਇਹ ਟੈਕਨੋਲੋਜੀ ਦੇ ਨਾਲ ਨਾਲ ਹੀ ਹਨ ਜੋ ਪੰਜਾਬ 'ਚ ਲੋਕਲ ਵੀ ਕਾਫ਼ੀ ਇਸਤੇਮਾਲ ਹੋ ਰਹੇ ਹਨ